ਹੈਲੋ ਜੀ ਫਿਲਿੱਪਕਾਰਟ ਤੋਂ ਬੋਲ ਰਹੇ ਜੀ ਮੈਂ ਸ਼ਰਟ ਬੁੱਕ ਕੀਤੀ ਸੀਗੀ ਜੀ ਸ਼ਰਟ ਤੁਹਾਡੀ ਆ ਗਈ ਆ ਜੀ ਪੈਕਿੰਗ ਬਹੁਤ ਵਧੀਆ ਸੀਗੀ ਨੰਬਰ ਮੇਰਾ ਹੀ ਆਇਆ ਜੀ ਅਤੇ ਸ਼ਰਟ ਦੀ ਫੀਟਿੰਗ ਬਹੁਤ ਵਧੀਆ ਹੈ ਅਤੇ ਮੈਨੂੰ ਬੜੀ ਪਸੰਦ ਆਈ